ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ ਬੋਲੋ ਹਾਂਜੀ ਅਸੀਂ ਲੋਕਲ ਲੋਕਲੀ ਮੁਕਤਸਰ ਤੋਂ ਲੋਕਲ ਹੀ ਹੈ

ਸਟ੍ਰੀਟ ਫੂਡ ਬਾਰੇ ਜਾਣਕਾਰੀ ਲੈਣੀ ਸੀ ਸਟ੍ਰੀਟ ਫੂਡ ਮੁਕਤਸਰ ਵਿੱਚ ਸਟ੍ਰੀਟ ਫੂਡ ਕਿੱਥੇ ਕਿੱਥੇ ਹੈ ਠੀਕ ਹੈ ਕੋਈ ਗੱਲ ਨਹੀਂ ਮੈਂ ਹਾਂਜੀ ਹਾਂਜੀ ਹਾਂਜੀ ਆਪਣੇ ਨਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੀ ਮੈਂ ਸਟਾਰਟ ਕਰਦੀ ਕਿੱਥੇ ਮੈਂ ਆਪਾਂ ਬਹੁਤ ਟਰਾਈ ਕੀਤਾ ਸਾਰੇ ਅ ਸਾਰੇ ਸ਼ਹਿਰ 'ਚ ਟਰਾਈ ਕੀਤਾ ਬਹੁਤ ਫਾਸਟ ਫੂਡ ਮੈਨੂੰ ਬਹੁਤ ਪਸੰਦ ਹੈਗਾ ਫਿਰ ਫਾਸਟ ਫੂਡ ਕੋਈ ਵੀ ਹੋਵੇ ਜਿਵੇਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜਿਵੇਂ ਕੋਟਕਪੂਰਾ ਰੋਡ 'ਤੇ ਓਕੇ ਜੀ ਵਾਲਿਆਂ ਦਾ ਹੈਗਾ ਜਿਵੇਂ ਉੱਥੇ ਚਾਈਨੀ ਅ ਚਾਈਨੀ ਚਾਈਨਾ ਵਾਲੇ ਆ ਹੈਗੇ ਆ ਚਾਈਨਾ ਤੋਂ ਆਏ ਹੈਗੇ ਉਹਨਾਂ ਦਾ ਹੈਗਾ ਉਸ ਉੱਥੇ ਮਤਲਬ ਮੋਮੋਜ਼ ਬਹੁਤ ਟੇਸਟੀ ਬਣਾਉਂਦੇ ਆ ਉਹ ਬਹੁਤ ਵਾਰੀ ਟਰਾਈ ਕੀਤੇ ਆ ਬਰਗਰ ਵੀ ਬਹੁਤ ਟੇਸਟੀ ਬਣਾਉਂਦੇ ਉੱਥੇ ਅਤੇ ਮਤਲਬ ਬਾਕੀ ਵੀ ਪਨੀਰ ਟਿੱਕਾ ਸਾਰਾ ਕੁਝ ਹੀ ਹੈਗੀਆਂ ਨੇ ਚਿਕਨ ਚਿਲੀ ਮਤਲਬ ਸਾਰਾ ਕੁਛ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਪੀਜਾ ਹਾਂਜੀ ਜਿਵੇਂ ਪੀਜ਼ਾ ਜਿਵੇਂ ਪੀਜ਼ਾ ਡੋਮੀ ਜਿਵੇਂ ਆਪਾਂ ਡੋਮੀਨੋਜ਼ ਵਾਲਿਆਂ ਦੇ ਆ ਆਹ ਕੋਟਕਪੂਰਾ ਬਾਈਪਾਸ 'ਤੇ ਹੈਗਾ ਡੋਮੀਨੋਜ਼ ਵਾਲਿਆਂ ਦਾ ਅਤੇ ਉਹਨਾਂ ਦਾ ਪੀਜਾ ਬਹੁਤ ਟੇਸਟੀ ਆ ਉੱਥੇ ਹੈਗਾ ਠੀਕ ਆ ਜਿਵੇਂ ਆਪਾਂ ਇੱਧਰ ਬੱਸ ਸਟੈਂਡ ਬੰਨੀ ਆ ਜਾਂਦੇ ਆ ਤਾਂ ਆ ਇੱਧਰ ਸਰਲਾ ਸਾਰਿਆਂ ਵਾਲਿਆਂ ਦੇ ਹੈਗੇ ਆ ਉਹਨਾਂ ਦਾ ਹੋਟਲ ਜਿਹਾ ਹੈਗਾ ਅਤੇ ਇੱਕ ਹੈਗਾ ਇੱਥੇ ਲਵਲੀ ਸਵੀਟਸ ਵਾਲਿਆਂ ਦਾ ਹੈਗਾ ਉਹਨਾਂ ਦੇ ਵੀ ਫਾਸਟ ਫੂਡ ਹੈਗਾ ਸਭ ਕੁਝ ਹੀ ਹੈਗਾ ਉਹਨਾਂ ਦੇ ਉਹਨਾਂ ਦੇ ਬਹੁਤ ਟੇਸਟੀ ਬਣਾਉਂਦੇ ਆ ਜਿਹੜੇ ਕਲਾਸ ਵਾਲੇ ਨੇ ਉਹਨਾਂ ਦੇ ਬਰਗਰ ਬਹੁਤ ਟੇਸਟੀ ਬਣਾਉਂਦੇ ਹੈਗੇ ਆ ਅਤੇ ਹਾਂ ਹਾਂਜੀ ਹਾਂਜੀ

ਜਿਵੇਂ ਇੱਕ ਹਾਂ ਇੱਕ ਪੱਪੂ ਸਮੋਸੇ ਵਾਲਾ ਉਹਨਾਂ ਦੇ ਵੀ ਬਹੁਤ ਟੇਸਟੀ ਅ ਬਣਾਇਆ ਜਾਂਦਾ ਫਾਸਟ ਫੂਡ ਉੱਥੇ ਵੀ ਤੁਸੀਂ ਟਰਾਈ ਕਰ ਸਕਦੇ ਹੋ ਉੱਥੇ ਵੀ ਜਾ ਸਕਦੇ ਹੋ ਅਤੇ ਇੱਕ ਹੈਗਾ ਇੱਥੇ ਕੋਟਕਪੁਰਾ ਚੌਂਕ ਦੇ ਵਿੱਚ ਹੁੰਦਾ ਦੀਪਕ ਉਹ ਉਹ ਰੇਹੜੀ 'ਤੇ ਫਾਸਟ ਫੂਡ ਉਹਨਾਂ ਦੇ ਬਹੁਤ ਟੇਸਟੀ ਹੁੰਦਾ ਸਭ ਕੁਝ ਜਿਵੇਂ ਗੋਲਗੱਪੇ ਉਹਨਾਂ ਦੇ ਬਹੁਤ ਟੇਸਟੀ ਹੁੰਦੇ ਆ ਅਤੇ ਉਹਨਾਂ ਦਾ ਅ ਮਤਲਬ ਦਹੀਂ ਭੱਲਾ ਬਹੁਤ ਟੇਸਟੀ ਹੁੰਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਮੈਂ

ਹਾਂਜੀ ਹਾਂ ਕੋਈ ਗੱਲ ਨਹੀਂ ਮੈਂ ਸਾਰਿਆਂ ਨੂੰ ਜਾਣਦੀ ਹਾਂ ਕੋਈ ਗੱਲ ਨਹੀਂ ਕੱਲ ਕੱਲ੍ਹ ਦਾ ਦਿਨ ਰੱਖ ਲਓ ਤੁਸੀਂ ਚਲੋ ਕੋਈ ਗੱਲ ਨਹੀਂ ਮੈਨੂੰ ਛੁੱਟੀ ਹੈਗੀ ਆ ਤਾਂ ਚਲ ਜਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ